ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕੋਣ ਬੋਲ ਰਹੇ ਹੋ ਓਕੇ ਹਾਂਜੀ ਮੈਂ ਮਤਲਬ ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਸੀ ਤੁਹਾਡਾ ਨੰਬਰ ਤੁਸੀਂ ਹੋਮ ਬਾਏ ਕਰਵਾਉਂਦੇ ਹੋ ਰੈਂਟ 'ਤੇ ਹਾਂਜੀ ਮੈਨੂੰ ਮਤਲਬ ਟੂ ਫਲੋਰ ਫਲੈਟ ਚਾਹੀਦਾ ਸੀ ਪੂਰਾ ਸੈਮੀ ਫਰਨਿਸ਼ਡ ਫਰਨਿਸ਼ਡ ਹੋਵੇੇ ਅਤੇ ਟਾਈਲ ਵਗੈਰਾ ਦਾ ਵੀ ਕੰਮ ਕੀਤਾ ਹੋਇਆ ਹਾਂਜੀ ਹੋਰ ਮਤਲਬ ਤੁਹਾਡੇ ਕਿੰਨੇ ਚਾਰਜਸ ਹੋ ਸਕਦੇ ਹੈ ਓਕੇ ਫਿਰ ਮਤਲਬ ਮੈਨੂੰ ਟਾਈਲਸ ਦਾ ਕੰਮ ਚਾਹੀਦਾ ਕਿਚਨ 'ਚ ਵੀ ਮੈਨੂੰ ਟਾਈਲਸ ਦਾ ਮਾੜਾ ਮੋਟਾ ਕੰਮ ਚਾਹੀਦਾ ਮਤਲਬ ਹਾਂਜੀ ਮਤਲਬ ਤੁਹਾਡੇ ਚਾਰਜਸ ਕਿੰਨੇ ਹੋਣਗੇ ਰੈਂਟ ਦੇ ਓਕੇ ਮੈਨੂੰ ਮਤਲਬ ਥੋੜ੍ਹੇ ਇੱਕ ਦੋ ਦਿਨਾਂ ਤੱਕ ਤੁਸੀਂ ਦੱਸ ਦਿਓ ਵੀ ਤੁਹਾਡੇ ਕਿੰਨਾ ਰੈਂਟ ਦੇ ਹੋਣਗੇ ਚਾਰਜਿਸ ਹਾਂਜੀ ਠੀਕ ਹੈ ਠੀਕ ਹੈ ਮੈਂ ਮਤਲਬ ਤੁਹਾਨੂੰ ਸੈਂਡ ਕਰ ਦੂਗੀ ਸਾਰੀ ਡਿਟੇਲ ਹਾਂਜੀ ਬੋਟਮ 'ਚ ਵੀ ਠੀਕ ਹੈ ਕੰਮ ਮੈਨੂੰ ਬੋਟਮ 'ਚ ਹੀ ਰੂਮ ਚਾਹੀਦੇ ਦੋ ਠੀਕ ਹੈ ਹਾਂਜੀ ਬਾਕੀ ਜਿਹੜੀ ਇਨਫਾਰਮੇਸ਼ਨ ਤੁਸੀਂ ਮੈਨੂੰ ਵਟਸਐਪ ਰਾਹੀਂ ਸ਼ੇਅਰ ਕਰਦੇ ਰਹਿਓ ਟਾਈਮ ਨਾਲ ਠੀਕ ਹੈ ਹਾਂਜੀ ਬਾਕੀ ਮਤਲਬ ਮੈਂ ਵਿਜਿਟ ਕਰੂੰਗੀ ਇੱਕ ਦੋ ਦਿਨਾਂ ਤੱਕ ਤੁਹਾਡੇ ਕੋਲ ਅਤੇ ਮੈਨੂੰ ਸਾਰੇ ਚਾਰਜਸ ਪਲਾਨ ਠੀਕ ਹੈ ਸਭ ਦੱਸ ਦਿਓ ਹਾਂਜੀ ਓਕੇ ਠੀਕ ਹੈ ਓਕੇ ਓਕੇ ਥੈਂਕ ਯੂ